ਹੈਲੋ ਤੁਸੀਂ ਵੋਲਵੋੋੋੋ ਬੱਸ ਏਜੰਸੀ ਤੋਂ ਬੋ ਬੋਲਣ ਦੇ ਅਸੀਂ ਹਰਿਆਣੇ ਤੋਂ ਆਉਣਾ ਆ ਤਰਨ ਤਾਰਨ ਲਾਗੇ ਬੰਨੇ ਸ਼ਹਿਰਾਂ ਵਿੱਚ ਘੁੰਮਣ ਵਾਸਤੇ ਅਤੇ ਤੁਹਾਡੀਆਂ ਬੱਸਾਂ ਚੱਲਦੀਆਂ ਨੇ ਇੱਧਰ ਹਾਂਜੀ ਹਾਂਜੀ ਹਾਂਜੀ

ਹਾਂਜੀ ਅਤੇ ਜਦੋਂ ਮੈਂ ਵਾਪਸ ਜਾਣਾ ਆ ਤਾਂ ਫਿਰ ਤੁਸੀਂ ਮੈਨੂੰ ਮਤਲਬ ਵਾਪਸ ਛੱਡ ਸਕਦੇ ਹੋ ਛੱਡਣ ਵਾਸਤੇ ਹੈ

ਠੀਕ ਹਾਂਜੀ

ਹਾਂਜੀ ਹਾਂਜੀ

ਹਾਂਜੀ ਅਤੇ ਤੁਹਾਡੀਆਂ ਬੱਸਾਂ ਪੰਜਾਬ ਤੋਂ ਬਾਹਰ ਵੀ ਜਾਂਦੀਆਂ ਨੇ ਪੰਜਾਬ ਤੋਂ ਬਾਹਰ ਵੀ ਜਾਂਦੀਆਂ ਤੁਹਾਡੀਆਂ ਬੱਸਾਂ ਹਾਂਜੀ ਠੀਕ ਹੈ ਜੀ ਥੈਂਕ ਯੂ ਜੀ